ਉਹ ਗਾਇਕੀ ਵਿੱਚ ਜਿੱਦਾਂ ਮਤਲਬ ਸੈਡ ਸੌਂਗ ਗਾਣੇ ਹੋ ਗਏ ਉਹ ਉਹਨੂੰ ਹੋਰ ਮਿਊਜਿਕ ਦਿੰਦੇ ਆ ਸੈਡ ਮਿਊਜਿਕ ਦੇਣਾ ਜਿਹੜਾ ਕੋਈ ਵੀ ਏ ਚੱਕਵਾਂ ਗਾਣਾ ਉਹਦੇ ਚੱਕਵਾਂ ਮਿਊਜਿਕ ਦੇਣਾ ਉਹਨੀ ਉਸ ਹਿਸਾਬ ਨਾਲ ਮਿਊਜਿਕ ਦਿੰਦੇ ਆ ਉਹ ਜਿਹੜਾ ਸੁਰ ਚੱਕਦੇ ਇੱਕ ਜਿਹੜੀ ਗਾਣੇ ਦੀ ਵੀਡੀਓ ਬਣਾਉਂਦੇ ਆ ਵੀਡੀਓ ਇੱਦਾਂ ਦੀ ਬਣਾਉਂਦੇ ਆ ਵੀ ਬੰਦਾ ਆਪਣੇ ਪਰਿਵਾਰ ਵਿੱਚ ਬਹਿ ਕੇ ਦੇਖਣ ਨੂੰ ਦੇ ਦੇਖ ਸਕਦਾ ਵੀਡੀਓ ਇੱਦਾਂ ਦੀ ਜਿੱਦਾਂ ਲੁਚ ਬਲੁੱਚ ਨਹੀਂ ਪਾਉਂਦੇ ਜਿੱਦਾਂ ਲੁਚ ਬਲੁੱਚ ਕਈ ਬੰਦਾ ਆਪਣੇ ਪਰਿਵਾਰ 'ਚ ਬਹਿ ਕੇ ਵੀ ਨਹੀਂ ਦੇਖ ਸਕਦਾ ਠੀਕ ਹੈ ਸੈਡ ਸੌਂਗ ਗਾਣਿਆਂ ਦੀ ਬੰਦਾ ਜਿੱਦਾਂ ਮਿਊਜਿਕ ਉਸ ਹਿਸਾਬ ਨਾਲ ਤਿਆਰ ਕਰਨਾ ਸੈਡ ਸੌਂਗ ਗਾਣੇ ਦਾ ਵੀ ਵਧੀਆ ਤਰੀਕੇ ਨਾਲ ਜਿਹੜਾ ਚੱਕਵਾਂ ਗਾਣਾ ਉਹਦਾ ਚੱਕਵਾਂ ਮਿਊਜਿਕ ਰੱਖਦੇ ਆ ਉਹ